ਉੱਦਾਂ ਤਾਂ ਜੀ ਮੇਰੇ ਕੋਲ ਬਹੁਤ ਸਾਰੇ ਪ੍ਰੋਡਕਟ ਹਨ ਪਰ ਮੈਂ ਜਿਹੜਾ ਮੇਰਾ ਫਸਟ ਪ੍ਰੋਡਕਟ ਸੀਗਾ ਜਿਹਨੂੰ ਮੈਂ ਹੁਣ ਵੀ ਬਿਜ਼ਨਸ ਵਿੱਚ ਬਹੁਤ ਯੂਜ਼ ਕਰਦਾਂ ਉਹ ਸੀਗਾ ਮੇਰਾ ਕੈਮਰਾ ਜੀ ਸੋਨੀ ਦਾ ਉਹਨੂੰ ਮੈਂ ਚੰਡੀਗੜ੍ਹ ਤੋਂ ਖਰੀਦਿਆ ਸੀਗਾ ਜੀ ਸੈਕਟਰ ਬਾਈ ਤੋਂ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਫੀਚਰ ਹਨ ਜਿਵੇਂ ਕਿ ਉਹ ਵੀਡੀਓ ਸ਼ੂਟ 'ਚ ਜਿਵੇਂ ਵਿਆਹਾਂ 'ਚ ਸ਼ੂਟ ਕਰਦਾ ਉਹਦੇ 'ਤੇ ਵੀ ਕੰਮ ਆਉਂਦਾ ਜਾਂ ਮੈਂ ਰੀਅਲ ਸਟੇਟ ਦਾ ਸ਼ੂਟ ਕਰਦਾਂ ਜੀ ਗਾਣਿਆਂ ਦਾ ਸ਼ੂਟ ਕਰਦਾਂ ਉਹਦੇ ਵਿੱਚ ਵੀ ਮੇਰੇ ਬਹੁਤ ਕੰਮ ਆਉਂਦਾ ਏ ਜੀ ਅਤੇ ਉਹਦੇ ਵਿੱਚ ਬਹੁਤ ਤਰ੍ਹਾਂ ਦੇ ਫੀਚਰ ਹਨ ਜਿਹਦੇ ਵਿੱਚ ਆਪਾਂ ਸਲੋ ਮੋਸ਼ਨ ਵੀਡੀਓ ਕੈਪ ਕੈਪਚਰ ਕਰ ਸਕਦੇ ਹਾਂ ਜੀ ਅਤੇ ਆਪਾਂ ਹਾਈ ਕੁਆਲਿਟੀ ਫੋਟੋਸ ਕਲਿੱਕ ਕਰ ਸਕਦੇ ਹਾਂ ਉਹਦੇ ਨਾਲ ਅਤੇ ਆਪਾਂ ਉਹਦੇ ਵਿੱਚ ਜਿਹੜੀ ਆਪਣੀ ਡੈਫਥ ਵੀਡੀਓ ਹੁੰਦੀ ਹੈ ਜੀ ਉਹ ਵੀ ਕੈਪਚਰ ਕਰ ਸਕਦੇ ਹਨ ਅਤੇ ਇਹ ਇਹ ਕੈਮਰਾ ਮੈਨੂੰ ਬਿਜ਼ਨਸ ਵਿੱਚ ਬਹੁਤ ਹੈਲਪ ਕਰਦਾ ਹੈ ਅਤੇ ਪਹਿਲਾਂ ਮੈਨੂੰ ਬਹੁਤ ਮੁਸ਼ਕਿਲ ਸੀਗਾ ਕੰਮ ਕਰਨਾ ਬਿਨਾਂ ਕੈਮਰੇ ਤੋਂ ਪਰ ਉਹ ਜਦੋਂ ਦਾ ਮੈਂ ਕ ਕੈਮਰਾ ਲਿਆ ਹੈ ਮੇਰੀ ਜਿਹੜੇ ਸ਼ੂਟਸ ਹਨ ਬਹੁਤ ਜ਼ਿਆਦਾ ਈਜ਼ੀ ਹੋ ਗਏ ਨੇ